ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਅਲੱਗ ਅਲੱਗ ਨਰਸਰੀਆਂ ਤੋਂ ਬੀਜ ਲਿਆਉਂਦੀ ਹਾਂ ਅਤੇ ਕੁਝ ਕੁਝ ਫੁੱਲ ਮੈਂ ਆਪਣੇ ਘਰੋਂ ਵੀ ਤਿਆਰ ਕਰਦੀ ਹਾਂ ਜਿਵੇਂ ਕਿ ਗੇਂਦੇ ਦੇ ਫੁੱਲ ਫੁੱਲਾਂ ਨੂੰ ਸੁਕਾ ਕੇ ਉਹਨਾਂ ਦੇ ਬੀਜ ਲੈ ਕੇ ਉਹਨਾਂ ਨੂੰ ਬਾੜੀ ਦੇ ਵਿੱਚ ਖਿਲਾਰ ਦਿੰਦੀ ਹਾਂ ਤਾਂ ਉਹਨਾਂ ਤੋਂ ਫੁੱਲ ਤਿਆਰ ਹੋ ਜਾਂਦੇ ਆ ਅਤੇ ਜਿਵੇਂ ਕਿ ਗੁਲਾਬ ਦੀਆਂ ਕਲਮਾਂ ਨੂੰ ਕੱਟ ਕੇ ਅਤੇ ਉਹ ਕਲਮ ਉਗਾ ਦਿੰਦੀ ਹਾਂ ਤਾਂ ਉਸ ਤੋਂ ਵੀ ਮਤਲਬ ਕਿ ਪੌਦਾ ਤਿਆਰ ਹੋ ਜਾਂਦਾ ਹੈ ਅਤੇ ਇਹ ਫੁੱਲ ਮਤਲਬ ਕਿ ਮੈਂ ਘਰੇ ਵੀ ਤਿਆਰ ਕਰ ਲੈਂਦੀ ਹਾਂ ਅਤੇ ਇਹ ਟੁਕੜਾ ਦੇ ਬੀਜ ਤੋਂ ਲੈ ਕੇ ਦੇ ਜਨਮ ਦੀ ਪ੍ਰਕਿਰਿਆ ਨੂੰ ਦਰਸਾਉਂਦਾ ਹੈ ਜਦੋਂ ਤੱਕ ਇਹ ਬੀਜ ਇੱਕ ਬੀਜ ਵਿੱਚ ਨਹੀਂ ਬਦਲ ਜਾਂਦਾ ਜਦੋਂ ਇਸ ਦੇ ਪਹਿਲੇ ਪੱਤੇ ਖੁੱਲ੍ਹਦੇ ਹਨ ਇਸ ਅਤੇ ਇਸ ਵੀਡੀਓ ਦੇ ਲੇਖਕ ਨੇ ਦੇ ਅਨੁਸਾਰ ਸਤੰਬਰ ਵਿੱਚ ਲਿਆ ਗਿਆ ਸੀ ਅਤੇ ਇਹਨਾਂ ਨੂੰ ਇਹਨਾਂ ਨੂੰ ਜਦੋਂ ਉਗਾਉਂਦੇ ਹਾਂ ਤਾਂ ਖਾਦ ਵੀ ਪਾਈ ਜਾਂਦੀ ਹੈ ਖਾਦ ਪਾ ਕੇ ਬੀਜ ਤਿਆਰ ਕੀਤੇ ਜਾਂਦੇ ਹਨ ਅਤੇ ਇਹਨਾਂ ਇਹਨਾਂ ਨੂੰ ਮਤਲਬ ਕਿ ਜਿਵੇਂ ਅੱਠ ਨੌਂ ਮਹੀਨਿਆਂ ਤੱਕ ਇਹ ਪੂਰੇ ਤਿਆਰ ਹੋ ਜਾਂਦੇ ਆ ਪਹਿਲਾਂ ਤਾਂ ਨਿੱਕੇ ਨਿੱਕੇ ਇਹਨਾਂ ਦੇ ਪੱਤੇ ਉੱਗਦੇ ਆ ਅਤੇ ਫਿਰ ਇਹ ਮਤਲਬ ਕਿ ਪੂਰੀ ਤਰ੍ਹਾਂ ਤਿਆਰ ਹੋ ਜਾਂਦੇ ਆ

ਅਤੇ ਇਹ ਪ੍ਰਕਿਰਿਆ ਜਦੋਂ ਕੁਦਰਤ ਵਿੱਚ ਅੱਠ ਮਹੀਨਿਆਂ ਤੱਕ ਚੱਲਦੀ ਹੈ ਇੱਕ ਸਮਾਂ ਲੰਘਣ ਦੁਆਰਾ ਸਿਰਫ਼ ਤਿੰਨ ਮਿੰਟਾਂ ਵਿੱਚ ਸੰਘਣੀ ਹੋ ਗਈ ਹੈ ਇਹ ਤਕਨੀਕ ਸਥਿਤ ਚਿੱਤਰਾਂ ਦੇ ਲਗਾਤਾਰ ਪਰਜ ਜਨ ਤੋਂ ਅੰਦੋਲਨ ਦਾ ਭਰਮ ਪੈਦਾ ਕਰਨ ਦੀ ਆਗਿਆ ਹੈ ਇਹ ਸਥਿਤੀ ਵਿੱਚ ਵੀਡੀਓ ਦਾ ਹਰੇਕ ਫਰੇਮ ਪਿਛਲੇ ਇੱਕ ਦੇ ਸੰਬੰਧ ਵਿੱਚ ਦੋ ਘੰਟਿਆਂ ਦੇ ਫਰਕ ਨਾਲ ਲਈ ਗਈ ਹੈ ਰੱਦੀ ਵਿੱਚ ਸੁੱਟਣ ਜਾਂ ਸਾੜਨ ਦੀ ਬਜਾਏ ਸਾਨੁੂੰ ਘਰੇਲੂ ਖਾਦ ਵਰਤਿਆ ਜਾ ਸਕਦਾ ਹੈ ਸਾਨੂੰ ਬਹੁਤ ਸਾਰੇ ਢਾਚਿਆਂ ਨੂੰ ਆਮ ਤੌਰ 'ਤੇ ਬੀਜ ਕਿਹਾ ਜਾਂਦਾ ਹੈ ਅਸਲ ਵਿੱਚ ਸੁੱਕੇ ਫ਼ਲ ਹਨ ਬੇਰੀ ਪੈਦਾ ਕਰਨ ਵਾਲੇ ਪੌਦੇ ਕਹਿੰਦੇ ਹਨ ਸੂਰਜਮੁਖੀ ਦੇ ਬੀਜ ਕਦੇ ਕਦੇ ਵਪਾਰਿਕ ਤੌਰ 'ਤੇ ਵੇਚੇ ਜਾਂਦੇ ਹਨ ਜਦੋਂ ਕਿ ਇਹ ਫ਼ਲਾਂ ਦੀ ਸਖਤ ਕੰਧ ਸਖਤ ਕੰਧ ਦੇ ਅੰਦਰ ਘੇਰਿਆ ਹੁੰਦਾ ਹੈ ਜਿਸ ਨੂੰ ਬੀਜਾਂ ਤੱਕ ਪਹੁੰਚਾਉਣ ਲਈ ਖੁੱਲ੍ਹਾ ਛੱਡਣਾ ਚਾਹੀਦਾ ਹੈ ਪੌਦਿਆਂ ਦੇ ਵੱਖ ਵੱਖ ਸਮੂਹਾਂ ਵਿੱਚ ਹੋਰ ਸੋਧਾਂ ਹਨ ਇਸ ਲਈ ਕਹਿੰਦੇ ਪੱਤੇ ਦੇ ਫ਼ਲ ਕੋਲ ਇੱਕ ਕਠੋਰ ਫਰਖ ਲੇਅਰ ਹੈ ਸਾਨੂੰ ਫੁੱਲਾਂ ਜਦੋਂ ਉਹ ਉੱਗ ਜਾਂਦੇ ਹਨ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਉਹਨਾਂ ਨੂੰ ਖਾਦ ਸਮੇਂ ਸਿਰ ਖਾਦ ਸਮੇਂ ਸਿਰ ਪਾਣੀ ਲਗਾਉਣਾ ਚਾਹੀਦਾ ਹੈ